ਜਦੋਂ ਮੈਂ ਪਹਿਲੀ ਵਾਰ ਕੰਮ 'ਤੇ ਗਈ ਤਾਂ ਉੱਥੇ ਕੰਮ ਦਾ ਬੋਝ ਜ਼ਿਆਦਾ ਹੋਣ ਕਰਕੇ ਅਤੇ ਤਜ਼ਰਬੇ ਦੀ ਘਾਟ ਹੋਣ ਕਰਕੇ ਮੇਰੇ ਕੋਲੋਂ ਗਲਤੀ ਹੋ ਗਈ ਲੇਕਿਨ ਬਹੁਤ ਹੀ ਸੂਝ ਬੂਝ ਨਾਲ ਮੈਂ ਉਸਨੂੰ ਸੰਭਾਲ ਲਿਆ